ਪਿੰਡ ਵਿੱਚ ਬਿਜਲੀ ਲਈ ਕਈ ਸਾਰੇ ਟਰਾਂਸਫਾਰਮਰ ਲੱਗ ਸਕਦੇ ਹਨ ਅਤੇ ਸੋਲਰ ਪੈਨਲ ਲਗਾਏ ਜਾ ਸਕਦੇ ਹਨ ਅਤੇ ਖੇਤਾਂ ਵਿੱਚ ਚੱਲਣ ਵਾਲੇ ਬਿਜਲੀ ਉਪਕਰਨ ਜਿਵੇਂ ਕਿ ਕਈ ਸਾਰੀਆਂ ਮੋਟਰਾਂ ਪਾਣੀ ਵਾਲੀ ਮੋਟਰ ਅਤੇ ਹੋਰ ਬਿਜਲੀ ਉਪਕਰਨ ਵਿੱਚ ਜਿਵੇਂ ਕਿ ਹੋਰ ਖੇਤੀ ਨਾਲ ਜੁੜੇ ਵੇ ਸਾਧਨ ਜਿਨ੍ਹਾਂ ਦੇ ਰਾਹੀਂ ਅਸੀਂ ਖਾਦ ਵਗੈਰਾ ਅਤੇ ਹੋਰ ਚੀਜ਼ਾਂ ਬਣਾ ਸਕਦੇ ਹਨ ਆਦਿ ਸਾਡੇ ਲਈ ਬਿਜਲੀ ਦੇ ਨਾਲ ਵਰਤੇ ਜਾਣ ਵਾਲੀਆਂ ਚੀਜ਼ਾਂ ਹਨ